ਜ਼ਿਆਦਾਤਰ ਲੋਕ ਘਰ ਬਣਾਏ ਕੱਪੜਿਆਂ ਨੂੰ ਮਹੱਤਤਾ ਦਿੰਦੇ ਨੇ ਬਾਜ਼ਾਰ ਵਿੱਚੋਂ ਬਣੇ ਬਣਾਏ ਕੱਪੜਿਆਂ ਨਾਲੋਂ ਘਰ ਬਣਾਏ ਕੱਪੜੇ ਜ਼ਿਆਦਾ ਆਰਾਮਦਾਇਕ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਆਪਾਂ ਆਪਣੇ ਹਿਸਾਬ ਨਾਲ ਜਿਵੇਂ ਮਰਜ਼ੀ ਬਣਾ ਸਕਦੇ ਹਾਂ ਬਾਜ਼ਾਰ ਦੇ ਵਿੱਚ ਜਿਵੇਂ ਦਾ ਆਪਾਂ ਨੂੰ ਮਿਲ ਗਿਆ ਉਵੇਂ ਦਾ ਆਪਾਂ ਨੂੰ ਉਹ ਮੰਨ ਹੰਡਾਉਣਾ ਪਊਗਾ ਘਰ ਬਣਾਏ ਕੱਪੜੇ ਮਜ਼ਬੂਤ ਵੀ ਹੁੰਦੇ ਨੇ ਜਲਦੀ ਖਰਾਬ ਨਹੀਂ ਹੁੰਦੇ ਮਤਲਬ ਕਿ ਉਹਨਾਂ ਦੀਆਂ ਜਿਹੜੀਆਂ ਸ ਸ ਸਿਲਾਈ ਲਗਾਈ ਹੁੰਦੀ ਹੈ ਉਹ ਜਲਦੀ ਨਹੀਂ ਨਿਕਲਦੀ ਜਿਹੜੇ ਬਾਜ਼ਾਰ ਵਾਲੇ ਕੱਪੜੇ ਹੁੰਦੇ ਨੇ ਉਹਨਾਂ ਦੀ ਜਿਹੜੀ ਸਿਲਾਈ ਹੁੰਦੀ ਹੈ ਬਹੁਤ ਹਲਕੀ ਲਗਾਈ ਹੁੰਦੀ ਹੈ ਮਸ਼ੀਨਾਂ ਦੁਆਰਾ ਲਗਾਈ ਜਲਦੀ ਵਿੱਚ ਕਾਹਲੀ ਕਾਹਲੀ ਵਿੱਚ ਲਾਈ ਹੁੰਦੀ ਹੈ ਉਹ ਨਿਕਲ ਜਾਂਦੀ ਹੈ ਜਲਦੀ ਖੁਸ ਜਾਂਦੀ ਹੈ ਜਲਦੀ ਬਹੁਤ ਜ਼ਿਆਦਾ ਇਸ ਲਈ ਆਪਾਂ ਨੂੰ ਜਿਹੜੇ ਬਾਜ਼ਾਰ ਵਾਲੇ ਕੱਪੜੇ ਨੇ ਉਹਨਾਂ ਨਾਲੋਂ ਜ਼ਿਆਦਾਤਰ ਲੋਕ